ਬੱਚਿਆਂ ਲਈ ਡਰਾਇੰਗ ਅਤੇ ਪੇਂਟਿੰਗ ਵਰਗੀਆਂ ਕਲਾਵਾਂ ਸ਼ੁਰੂ ਕਰਨ ਲਈ ਕੋਈ ਸਹੀ ਉਮਰ ਨਿਰਧਾਰਤ ਨਹੀਂ ਕੀਤੀ ਗਈ ਕਿਉਂਕਿ ਜੋ ਜਿਹੜੀ ਡਰਾਇੰਗ ਵਗੈਰਾ ਹੈ ਅੱਜ ਕੱਲ੍ਹ ਬੱਚਿਆਂ ਨੂੰ ਪਲੇਅਵੇਅ ਸਕੂਲ ਤੋਂ ਹੀ ਸਟਾਰਟ ਕਰ ਦਿੱਤੀ ਗਈ ਹੈ ਕਿਉਂਕਿ ਬੱਚੇ ਆਰਾਮ ਨਾਲ ਉਸ ਤੋਂ ਸਟਾਰਟਿੰਗ ਕਰਦੇ ਹਨ ਅਤੇ ਜਿਵੇਂ ਉਨ੍ਹਾਂ ਦਾ ਪੀਰੀਅਡ ਹੁੰਦਾ ਹੈ ਜੋ ਵੀ ਹੈ ਉਹਦੇ ਵਿੱਚ ਸਿਖਾਇਆ ਜਾਂਦਾ ਹੈ ਬੱਚੇ ਸਭ ਤੋਂ ਪਹਿਲਾਂ ਤਾਂ ਆਪਣਾ ਕਰੇਓਨਜ਼ ਵਗੈਰਾ ਤੋਂ ਸਟਾਰਟ ਕਰਦੇ ਹਨ ਜਿਵੇਂ ਜਿਵੇਂ ਬੱਚਾ ਬੜਾ ਹੋਈ ਜਾਂਦਾ ਹੈ ਉਸ ਤੋਂ ਬਾਅਦ ਕਦੇ ਸਕੈੱਚ ਵਗੈਰਾ ਹੋ ਗਏ ਕਦੇ ਔਇਲ ਪੇਸਟਲ ਕਲਰ ਹੋ ਗਏ ਕਦੇ ਕੁਛ ਹੋ ਗਿਆ ਉਸ ਤੋਂ ਬਾਅਦ ਕੰਪਿਊਟਰ ਵਿੱਚ ਵੀ ਬੱਚੇ ਨੂੰ ਸਿਖਾਇਆ ਜਾਂਦਾ ਹੈ ਅਤੇ ਕੰਪਿਊਟਰ 'ਤੇ ਵੀ ਡਰਾਇੰਗ ਕਰਦੇ ਹਨ ਜ਼ਿਆਦਾਤਰ ਤਾਂ ਇਸ ਦੇ ਵਿੱਚ ਕੋਈ ਉਮਰ ਦਾ ਗੱਲ ਕਰੀ ਜਾਵੇ ਤਾਂ ਉਮਰ ਕੋਈ ਨਿਰਧਾਰਤ ਨਹੀਂ ਕੀਤੀ ਗਈ ਜਿਵੇਂ ਜਿਵੇਂ ਬੱਚਾ ਬੜਾ ਹੋਈ ਜਾਂਦਾ ਹੈ ਉਹ ਅੱਗੇ ਫਿਰ ਹੋਰ ਵੀ ਵਾਟਰਕਲਰਜ ਯੂਜ਼ ਕਰਦਾ ਹੈ ਵਾਟਰਕਲਰ ਤੋਂ ਬਾਅਦ ਫਿਰ ਜਿਹੜੇ ਮੇਨ ਮੇਨ ਪੇਂਟ ਕਲਰ ਹੁੰਦੇ ਨੇ ਉਹ ਯੂਜ਼ ਕਰਦਾ ਹੈ ਉਸ ਤੋਂ ਬਾਅਦ ਜਿਹਨੇ ਪੇਂਟਰ ਬਣਨਾ ਬੰਦਾ ਪੇਂਟਰ ਬਣ ਜਾਂਦਾ ਹੈ